ਹਾਂਜੀ ਸਾਡੇ ਵਿਚਾਰ ਦੇ ਹਿਸਾਬ ਨਾਲ ਤਕਨੀਕੀ ਉਤਪਾਦਾਂ ਵਿੱਚ ਸਭ ਤੋਂ ਮਹੱਤਵਪੂਰਨ ਜਗ੍ਹਾ ਮੋਬਾਇਲ ਫੋਨ ਦੀ ਹੈ ਜੋ ਕਿ ਅਸੀਂ ਘਰ ਬੈਠੇ ਕਈ ਤਰ੍ਹਾਂ ਦੇ ਕੰਮ ਕਰ ਸਕਦੇ ਹਾਂ ਦੂਰ ਬੈਠੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਵਿਦੇਸ਼ਾਂ ਦੇ ਵਿੱਚ ਗਏ ਹੋਏ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਦੇ ਵੀਡੀਓ ਕਾਲ ਕਰ ਸਕਦੇ ਹਾਂ ਲੋਕੇਸ਼ਨ ਦੇਖ ਸਕਦੇ ਹਾਂ ਉਹ ਏਰੀਆ ਦੇਖ ਸਕਦੇ ਹਾਂ ਜਿਸ ਜਗ੍ਹਾ 'ਤੇ ਸਾਡਾ ਰਿਸ਼ਤੇਦਾਰ ਜਾਂ ਭੈਣ ਭਰਾ ਕੰਮ ਕਰ ਰਿਹਾ ਹੈ ਔਰ ਔਰ ਦੂਸਰੇ ਨੰਬਰ 'ਤੇ ਅਸੀਂ ਇਹ ਹੈ ਕਿ ਅਸੀਂ ਆਨਲਾਈਨ ਟ੍ਰਾਂਜੈਕਸ਼ਨ ਦਾ ਬੜਾ ਫਾਇਦਾ ਹੈ ਸਭ ਤੋਂ ਪਹਿਲੇ ਨੰਬਰ 'ਤੇ ਫੋਨ ਦਾ ਇੱਕ ਬੜਾ ਹੀ ਵਧੀਆ ਉਪਰਾਲਾ ਹੈ ਅਤੇ ਦੂਸਰੇ ਨੰਬਰ ਦੇ ਉੱਤੇ ਹੈ ਜਨਰੇਟਰ ਜੇ ਕਿੱਥੇ ਸਾਡੇ ਬਿਜਲੀ ਚਲੀ ਜਾਂਦੀ ਹੈ ਪਾਵਰ ਕੱਟ ਹੋ ਜਾਂਦਾ ਹੈ ਅਤੇ ਸਾਡਾ ਸਾਰਾ ਸਿਲਸਿਲਾ ਤਾਮਜਾਮ ਖਤਮ ਹੋ ਜਾਂਦਾ ਹੈ ਬੰਦ ਹੋ ਜਾਂਦਾ ਇਸ ਲਈ ਜਨਰੇਟਰ ਦੀ ਸੁਵਿਧਾ ਨਾਲ ਅਸੀਂ ਸਾਰੇ ਸਿਲਸਿਲੇ ਨੂੰ ਚਲਾ ਸਕਦੇ ਹਾਂ ਲਗਾਤਾਰ ਕੰਮ ਲੈ ਸਕਦੇ ਹੈ ਸਾਡੀ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਇੰਡਸਟਰੀ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਕੰਮ ਲਗਾਤਾਰ ਹੁੰਦਾ ਹੈ ਪ੍ਰੋਡਕਸ਼ਨ ਨਿਕਲਦੀ ਰਹਿੰਦੀ ਹੈ ਅਤੇ ਉਸ ਤੋਂ ਅਗਲੇ ਨੰਬਰ 'ਤੇ ਹੈ ਗੀਜ਼ਰ ਜੋ ਕਿ ਸਰਦੀਆਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜਿਸ ਦੇ ਨਾਲ ਆਪਾਂ ਨਹਾ ਸਕਦੇ ਹਾਂ ਗਰਮ ਪਾਣੀ ਨਾਲ ਬਰਤਨ ਸਾਫ ਕਰ ਸਕਦੇ ਹਾਂ ਬੱਚਿਆਂ ਨੂੰ ਨੁਆ ਸਕਦੇ ਹਾਂ ਜੋ ਕਿ ਬਿਮਾਰੀ ਤੋਂ ਠੰਡ ਲੱਗਣ ਤੋਂ ਕਾਫੀ ਬਚਾਅ ਰਹਿੰਦਾ ਔਰ ਇੱਕ ਹੋਰ ਇਸ ਤੋਂ ਵੀ ਵਧੀਆ ਚੀਜ਼ ਹੈ ਏਸੀ ਜੋ ਕਿ ਗਰਮੀਆਂ ਦੇ ਵਿੱਚ ਅੱਜ ਕੱਲ੍ਹ ਜ਼ਿਆਦਾ ਟੈਂਪਰੇਚਰ ਹੋਣ ਹੋਣ ਕਰਕੇ ਜੋ ਕਿ ਸਾਡੇ ਤਾਂ ਟੈਂਪਰੇਚਰ ਲਗਭਗ ਪੰਤਾਲੀ ਡਿਗਰੀ ਤੱਕ ਚਲਾ ਜਾਂਦਾ ਹੈ ਏਸੀ ਨਾਲ ਬੜੀ ਅਸੀਂ ਰਾਹਤ ਨਾਲ ਬਹਿ ਕੇ ਆਰਾਮ ਨਾਲ ਕੰਮ ਕਰ ਸਕਦੇ ਹਾਂ ਰੈਸਟ ਕਰ ਸਕਦੇ ਹਾਂ ਅਗਰ ਜੇ ਕੋਈ ਬੰਦਾ ਕੰਮ ਕਰਦਾ ਹੈ ਨਾਈਟ ਸ਼ਿਫਟ 'ਤੇ ਆਉਂਦਾ ਹੈ ਉਹ ਦਿਨ ਵਿੱਚ ਚੰਗੀ ਆਰਾਮ ਨਾਲ ਰੈਸਟ ਕਰ ਸਕਦਾ ਠੀਕ ਹੈ ਜੀ